ਹੈਲੋ ਹਾਂ ਮਨਪ੍ਰੀਤ ਕਿਵੇਂ ਆ ਵਧੀਆ ਵਧੀਆ ਕੀ ਕਰੀ ਜਾਂਦੇ ਸੀ ਸਟੱਡੀ ਵਧੀਆ ਵਧੀਆ ਚੱਲੀ ਜਾਂਦੀ ਹੈ ਹੋਰ ਦੱਸੋ ਕਿਵੇਂ ਚਲਦੀ ਹੈ ਪੜ੍ਹਾਈ ਕਿੰਨਾ ਕਿੰਨਾ ਕੁ ਟਾਈਮ ਪੜ ਪੁੜ੍ਹ ਲੈਂਦੇ ਹੋ ਬਹੁਤ ਵਧੀਆ ਮਨਪ੍ਰੀਤ ਮੈਂ ਵੀ ਕੋਸ਼ਿਸ਼ ਬਹੁਤ ਕਰਦੀ ਹੁੰਦੀ ਹਾਂ ਵੀ ਮੈਂ ਜ਼ਿਆਦਾ ਪੜ੍ਹ ਸਕਾਂ ਪਰ ਤੈਨੂੰ ਪਤਾ ਸਾਡੇ ਘਰ ਦੇ ਹਾਲਾਤ ਕਿਸ ਤਰ੍ਹਾਂ ਦੇ ਨੇ ਟਾਈਮ ਬਹੁਤ ਘੱਟ ਮਿਲਦਾ ਯਾਰ ਮੈਂ ਸੋਚਦੀ ਸੀ ਕੋਈ ਕੋਚਿੰਗ ਸੈਂਟਰ ਜੁਆਇਨ ਕਰ ਲਈਏ ਹਾਂ ਯਾਰ ਕਾਲਜ ਤਾਂ ਕਈ ਨੇ ਕਾਲਜ ਤਾ ਦੇਖ ਐਲ ਬੀ ਐਸ ਕਾਲਜ ਹੈਗਾ ਉਹ ਵੀ ਵਧੀਆ ਐਸ ਡੀ ਕਾਲਜ ਵੀ ਬਹੁਤ ਵਧੀਆ ਮੰਨਿਆ ਜਾਂਦਾ ਪਰ ਐਸ ਡੀ ਕਾਲਜ ਦੇ ਵਿੱਚ ਨਾ ਸਟੱਡੀ ਵਾਈਜ਼ ਮੈਨੂੰ ਸਹੀ ਨਹੀਂ ਲੱਗਿਆ ਯਾਰ ਐਲ ਬੀ ਐਸ ਵਧੀਆ ਉਹ ਲੇਡੀਜ਼ ਲਈ ਵੀ ਜਿਵੇਂ ਗਲਜ਼ ਦਾ ਕਾਲਜ ਹੈ ਕੁੜੀਆਂ ਕੁੜੀਆਂ ਹੁੰਦੀਆਂ ਨੇ ਸਾਰਾ ਬਾਕੀ ਮਾਹੌਲ ਵਧੀਆ ਮੈਨੂੰ ਲੱਗਦਾ ਵੀ ਐਲ ਬੀ ਐਸ ਦੇ ਵਿੱਚ ਆਪਾਂ ਨੂੰ ਸਟੱਡੀ ਕਰ ਲੈਣੀ ਚਾਹੀਦੀ ਹੈ ਆਈਲਸ ਸੈਂਟਰ ਵੀ ਕਈ ਹੈਗੇ ਨੇ ਤੁਹਾਡੀ ਕੋਈ ਨੌਲੇਜ ਦੇ ਵਿੱਚ ਵੀ ਹੋਊਗਾ

ਹਾਂ ਹਾਂ ਆਪਾਂ ਇੱਕ ਦਿਨ ਫਰੀ ਹੋ ਕੇ ਚਲ ਜਾਂਦੇ ਹਾਂ ਸ਼ਾਮ ਦੇ ਟਾਈਮ 'ਚ ਦੇਖ ਲੈਂਦੇ ਹਾਂ ਉਹਨਾਂ ਨੂੰ ਵੀ ਕਿਸ ਤਰ੍ਹਾਂ ਦੀਆਂ ਕਿਉਂਕਿ ਇਹ ਆਪਾਂ ਨੂੰ ਦੇਣਗੇ ਵੀ ਕੋਚਿੰਗ ਵੀ ਦੇਣਗੇ ਇੱਕ ਜਾਂ ਦੋ ਦਿਨ ਜਿਹੜੀ ਡੈਮੋ ਕਲਾਸਿਸ ਵੀ ਤਾਂ ਲਗਵਾਉਂਦੇ ਨੇ ਆਪਾਂ ਨੂੰ ਉਹਨਾਂ ਦੀ ਕੁਆਲਿਟੀ ਦਾ ਪਤਾ ਲੱਗ ਜਾਊਗਾ ਹੋਰ ਮਨਪ੍ਰੀਤ ਹੁਣ ਆਏ ਆ ਇਕੱਲਾਂ ਆਪਾਂ ਇਧਰਲੀ ਸਾਈਡ 'ਤੇ ਵੀ ਨਾ ਇਹ ਬਰਦਾਸ਼ਤ ਕਰ ਸਕਦੇ ਵੀ ਆਪਾਂ ਇੱਧਰ ਹੀ ਆਸ ਲਗਾ ਕੇ ਬੈਠੇ ਰਹੀਏ ਆਇਲਸ ਵੱਲ ਵੀ ਧਿਆਨ ਦੇ ਲੈਂਦੇ ਹਾਂ ਯਾਰ ਕੀ ਪਤਾ ਉੱਧਰ ਹੀ ਫਿਊਚਰ ਬਣ ਜਾਏ ਆਪਣਾ ਹੋਰ ਤਾਂ ਠੀਕ ਹੈ ਬਸ ਫਿਰ ਠੀਕ ਆ ਆਪਾਂ ਇੱਕ ਅੱਧੇ ਦਿਨ ਦੇ ਵਿੱਚ ਜਾਂਦੇ ਹਾਂ ਜਾ ਕੇ ਫਿਰ ਪਤਾ ਕਰ ਲੈਂਦੇ ਹਾਂ ਅਤੇ ਸ਼ਾਮ ਦੇ ਟਾਈਮ ਵੀ ਆਪਾਂ ਸ਼ਾਮ ਦੇ ਟਾਈਮ ਦੇ ਵਿੱਚ ਜਾ ਕੇ ਦੇਖ ਲੈਂਦੇ ਹਾਂ ਹਾਂ ਮੈਂ ਮੰਡੇ ਨੂੰ ਮੈਂ ਮੰਡੇ ਫ੍ਰੀ ਹਾਂ ਮੰਡੇ ਸ਼ਾਮ ਨੂੰ ਆਪਾਂ ਚਲਦੇ ਹਾਂ ਠੀਕ ਹੈ ਓਕੇ ਓਕੇ ਜੀ ਓਕੇ ਬਾਏ